ਸਾਡੀ ਪੰਜਾਬ ਦੀ ਸੰਸਥਾ ਬਾਰੇ ਜਿਵੇਂ ਕਿ ਪਹਿਲੇ ਸੈਂਟਰ ਖੋਲ੍ਹੇ ਜਾਂਦੇ ਨੇ ਜਿਹਦੇ ਵਿੱਚ ਪੇਂਡੂ ਔਰਤਾਂ ਨੂੰ ਸਿੱਖਿਆ ਦੇ ਨਾਲ ਨਾਲ ਉਹਨਾਂ ਨੂੰ ਕੰਮ ਦਾ ਵੀ ਕੰਮ ਸ ਕੰਮ ਦੀ ਮਦਦ ਕੀਤੀ ਜਾਂਦੀ ਹੈ ਜਿਵੇਂ ਕਿ ਬਿਊਟੀ ਪਾਰਲ ਦਾ ਕੰਮ ਸਿਖਾਇਆ ਜਾਂਦਾ ਤਾਂ ਸਿਲਾਈ ਕਢਾਈ ਦਾ ਕੰਮ ਸਿਖਾਇਆ ਜਾਂਦਾ ਸਿਲਾਈ ਕਢਾਈ ਦੇ ਵਿੱਚ ਉਹ ਆਪਣਾ ਆਪ ਸਮਾਜਿਕ ਸੇਵਾ ਲਈ ਸਮਾਜਿਕ ਲਈ ਆਪਣੇ ਆਪ ਲਈ ਆਪਣਾ ਹੁਨਰ ਸਿੱਖਣ ਲਈ ਉਹ ਇੱਕ ਰੁਜ਼ਗਾਰ ਦਾ ਧੰਦਾ ਬਣ ਜਾਂਦਾ ਇਹਦੇ ਵਿੱਚ ਸੈਂਟਰ ਦੇ ਵਿੱਚ ਪਿੰਡਾਂ ਦੇ ਵਿੱਚ ਸੈਂਟਰ ਖੋਲ੍ਹੇ ਜਾਂਦੇ ਨੇ ਅਤੇ ਸੈਂਟਰ ਦੇ ਵਿੱਚ ਇੱਕ ਲੇਡੀ ਟੀਚਰ ਟੋਰ ਟੀਚਰ ਦੇ ਤੌਰ 'ਤੇ ਜਿਵੇਂ ਕਿ ਸਿਲਾਈ ਕਢਾਈ ਦੀ ਟੀਚਰ ਹੁੰਦੀ ਹੈ ਅਤੇ ਉਹਨਾਂ ਨੂੰ ਉਹਦੇ ਬਾਰੇ ਜਾਣਕਾਰੀ ਦਿੰਦੀ ਆ